ਪਾਣੀ ਨੂੰ ਫਿਲਟਰ ਕਰਨਾ ਅਤੇ ਸ਼ੁੱਧ ਰੱਖਣਾ ਅੱਜ ਕੱਲ੍ਹ ਦੇ ਸਮੇਂ ਵਿੱਚ ਕਾਫੀ ਜ਼ਰੂਰੀ ਹੋ ਗਿਆ ਹੈ ਪੁਰਾਣੇ ਜ਼ਮਾਨੇ ਵਿੱਚ ਪਾਣੀ ਕਾਫੀ ਸਾਫ ਸੁਥਰਾ ਆਉਂਦਾ ਸੀ ਪਰ ਜੇ ਅਸੀਂ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਪਾਣੀ ਇੰਨਾ ਸਾਫ ਸੁਥਰਾ ਨਹੀਂ ਆ ਰਿਹਾ ਹੈ ਸ਼ਹਿਰੀ ਇਲਾਕੇ ਵਿੱਚ ਤਾਂ ਪਾਣੀ ਕਾਫੀ ਜ਼ਿਆਦਾ ਹੀ ਪ੍ਰਦੂਸ਼ਿਤ ਹੋ ਗਿਆ ਹੈ ਜਿਸ ਕਰਕੇ ਸਿੱਧਾ ਸਾਫ ਪਾਣੀ ਮਿਲਣਾ ਕਾਫੀ ਔਖਾ ਹੋ ਗਿਆ ਹੈ ਜੇ ਆਪਾਂ ਨਲਕੇ ਦੇ ਪਾਣੀ ਦੀ ਗੱਲ ਕਰੀਏ ਤਾਂ ਉਸ ਨੂੰ ਸਿੱਧਾ ਪੀਣਾ ਸਿਹਤ ਲਈ ਕਾਫੀ ਹਾਨੀਕਾਰਕ ਵੀ ਹੋ ਸਕਦਾ ਹੈ ਇਸ ਕਰਕੇ ਪਾਣੀ ਨੂੰ ਸ਼ੁੱਧ ਰੱਖਣ ਲਈ ਸਾਡੇ ਕੋਲ ਆਧੁਨਿਕ ਤਕਨੀਕ ਵੀ ਹੈ ਅਤੇ ਅਸੀਂ ਘਰੇਲੂ ਇਲਾਜ ਵੀ ਕਰ ਸਕਦੇ ਹਾਂ ਜੇ ਆਪਾਂ ਆਧੁਨਿਕ ਤਕਨੀਕ ਬਾਰੇ ਗੱਲ ਕਰੀਏ ਤਾਂ ਅੱਜ ਕੱਲ੍ਹ ਇੱਕ ਆਰ ਓ ਪਿਊਰੀਫਾਇਰ ਆਉਂਦਾ ਹੈ ਜਿਸ ਦੀ ਵਰਤੋਂ ਨਾਲ ਅਸੀਂ ਪਾ ਸਾਫ ਸੁਥਰਾ ਪਾਣੀ ਪੀ ਸਕਦੇ ਹਾਂ ਇਸ ਨੂੰ ਸਿਰਫ ਆਪਣੇ ਘਰਾਂ ਵਿੱਚ ਲਾਉਣਾ ਹੈ ਜਿਸ ਦੇ ਨਾਲ ਇਹਦੇ ਵਿੱਚੋਂ ਸਿਰਫ ਸਾਫ ਪਾਣੀ ਹੀ ਨਿਕਲੇਗਾ ਪਰ ਜੇ ਆਪਾਂ ਘਰੇਲੂ ਇਲਾਜ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਅਨੁਸਾਰ ਜੇ ਆਪਾਂ ਪਾਣੀ ਨੂੰ ਚੰਗਾ ਉਬਾਲ ਦਈਏ ਤਾਂ ਪਾਣੀ ਇੱਕਦਮ ਸਾਫ ਹੋ ਜਾਂਦਾ ਹੈ ਇਸ ਵਿੱਚ ਜਿਹੜੇ ਕੀਟਾਣੂ ਹੁੰਦੇ ਹਨ ਉਹ ਗਰਮੀ ਕਰਕੇ ਮਰ ਜਾਂਦੇ ਹਨ ਅਤੇ ਪਾਣੀ ਸਾਫ ਹੋ ਜਾਂਦਾ ਹੈ ਇਸ ਲਈ ਆਪਾਂ ਕਹਿੰਦੇ ਹਨ ਕਿ ਪਾਣੀ ਨੂੰ ਸ਼ੁੱਧ ਕਰਕੇ ਪੀਣਾ ਹੀ ਸਾਡੀ ਸਿਹਤ ਲਈ ਵਧੀਆ ਹੈ